ਦੌੜਨ ਤੋਂ ਪਹਿਲਾਂ ਸਵੇਰੇ ਉੱਠਦੇ ਸਾਰ ਮੈਂ ਪਹਿਲਾਂ ਆਪਣੇ ਕਮਰੇ ਵਿੱਚ ਲੱਗੀ ਮਿਲਖਾ ਸਿੰਘ ਦੀ ਤਸਵੀਰ ਨੂੰ ਦੇਖਦਾ ਹਾਂ ਜਿਨ੍ਹਾਂ ਨੂੰ ਮੈਂ ਆਪਣਾ ਆਈਡਲ ਮੰਨਦਾ ਹਾਂ ਅਤੇ ਮੈਂ ਮਿਲਖਾ ਸਿੰਘ 'ਤੇ ਬਣੀਆਂ ਫਿਲਮਾਂ ਜਾਂ ਪੋਡਕਾਸ ਵੀ ਸੁਣਦਾ ਰਹਿੰਦਾ ਹਾਂ ਬਾਕੀ ਮੈਂ ਜਦੋਂ ਦੌੜ ਲਈ ਜਾਂਦਾ ਹਾਂ ਤਾਂ ਸਿੱਧੂ ਮੂਸੇਵਾਲੇ ਦੇ ਗਾਣੇ ਵੀ ਸੁਣਦਾ ਰਹਿੰਦਾ ਹਾਂ ਜਿਨ੍ਹਾਂ ਨੂੰ ਸੁਣ ਕੇ ਮੈਨੂੰ ਐਨਰਜੀ ਮਿਲਦੀ ਹੈ ਜਦੋਂ ਮੈਂ ਸੰਗੀਤ ਸੁਣਦਾ ਹਾਂ ਤਾਂ ਮੈਂ ਧਿਆਨ ਵਿੱਚ ਰੱਖਦਾ ਹਾਂ ਕਿ ਮੈਂ ਸਿਰਫ ਮੋਟੀਵੇਸ਼ਨਲੀ ਸੌਂਗ ਸੁਣਾ ਜਿਨ੍ਹਾਂ ਨੂੰ ਸੁਣ ਕੇ ਮੇਰਾ ਧਿਆਨ ਮੇਰੇ ਏਮ ਵੱਲ ਆਕਰਸ਼ਿਤ ਹੋ ਜਾਵੇ ਮੇਰਾ ਏਮ ਹੈ ਕਿ ਮੈਂ ਪਹਿਲਾਂ ਸਟੇਟ ਲੈਵਲ 'ਤੇ ਫਸਟ ਪ੍ਰਾਈਜ ਜਿੱਤਾਂ ਤਾਂ ਜੋ ਮੈਂ ਅੱਗੇ ਨੈਸ਼ਨਲ ਦੀ ਤਿਆਰੀ ਕਰਾਂ ਅਤੇ ਮੈਂ ਫਿਊਚਰ ਵਿੱਚ ਜਾ ਕੇ ਆਪਣੇ ਦੇਸ਼ ਲਈ ਓਲੰਪਿਕ ਵਿੱਚ ਇੱਕ ਗੋਲਡ ਮੈਡਲ ਹਾਸਲ ਕਰਨਾ ਚਾਹੁੰਦਾ ਹਾਂ ਅਤੇ ਵੱਧ ਤੋਂ ਵੱਧ ਤਰੱਕੀ ਪਾਉਣਾ ਚਾਹੁੰਦਾ ਹਾਂ ਅਤੇ ਇੱਕ ਦੌੜਨ ਮੈਰਾਥੋਨ ਨੂੰ ਉੱਤਲੇ ਲੈਵਲ 'ਤੇ ਲੈ ਕੇ ਜਾਣਾ ਚਾਹੁੰਦਾ ਹਾਂ